ਸਵੱਛ ਭਾਰਤ ਅਭਿਆਨ ਹੈ ਜਿਹੜੀ ਉਹ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਚਲਾਈ ਗਈ ਸੀ ਅਤੇ ਇਹ ਪੂਰੇ ਭਾਰਤ ਦੇ ਵਿੱਚ ਚਲਾਈ ਗਈ ਸੀ ਇਹਦਾ ਬਹੁਤ ਅਸਰ ਪਿਆ ਕਿ ਲੋਕ ਆਪਣੇ ਆਲੇ ਦੁਆਲੇ ਜਿਹੜੀ ਸਫਾਈ ਰੱਖਣ ਲੱਗੇ ਨੇ ਪਹਿਲਾਂ ਨਾਲੋਂ ਲੋਕ ਇਸ ਗੱਲ ਪ੍ਰਤੀ ਜਿਹੜੇ ਜਾਗਰੂਕ ਹੋਏ ਨੇ ਕਿ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਐੱਨ ਐੱਸ ਐੱਸ ਦੇ ਕੈਂਪ ਦੇ ਰੂਪ ਦੇ ਵਿੱਚ ਸਫਾਈ ਮੁਹਿੰਮ ਦੇ ਵਿੱਚ ਹਿੱਸਾ ਲਿਆ ਆ ਅਤੇ ਆਲੇ ਦੁਆਲੇ ਦੇ ਖੇਤਰ ਦੀ ਜੇ ਗੱਲ ਕਰੀਏ ਪਹਿਲਾਂ ਨਾਲੋਂ ਤਾਂ ਕਾਫੀ ਸੁਧਾਰ ਹੋਇਆ ਆ ਪਰ ਅਜੇ ਵੀ ਲੋਕਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਹੋਰ ਸਾਫ ਸੁਥਰਾ ਰੱਖ ਸਕੀਏ ਅਸੀਂ ਆਪਣੀ ਧਰਤੀ ਨੂੰ ਸਾਫ ਸੁਥਰਾ ਰੱਖ ਸਕੀਏ ਅਤੇ ਇਸ ਤੋਂ ਇਲਾਵਾ ਆਪਣੇ ਵਾਤਾਵਰਨ ਨੂੰ ਵੀ ਸਾਫ ਸੁਥਰਾ ਰੱਖ ਸਕੀਏ ਤਾਂ ਕਿ ਅਸੀਂ ਵਧੀਆ ਜਿਹੜਾ ਮਹਿਸੂਸ ਕਰ ਸਕੀਏ